ਸਾਡੇ ਖੇਤਰ ਵਿੱਚ ਕਲਾ ਅਤੇ ਸੱਭਿਆਚਾਰ ਦੇ ਵਿਕਾਸ ਵਿੱਚ ਸਹਾਇਤਾ ਕਰਨ ਵਾਲੇ ਫੀਡਿੰਗ ਸਰੋਤ ਪਰਉਪਕਾਰੀ ਦਾਨੀ ਹਨ ਇਹ ਆਪਣੇ ਕਰੋਨਾ ਭਾਵ ਦਇਆ ਭਾਵ ਪ੍ਰੇਮ ਭਾਵਨਾ ਕਰਕੇ ਲੋਕਾਂ ਵਿੱਚ ਫ ਇਹ ਗੱਲ ਫੈਲਾਉਂਦੇ ਹਨ ਕਿ ਸਾਡਾ ਪੰਜਾਬੀ ਸੱਭਿਆਚਾਰ ਕਲਾ ਸਾਡੀ ਆਨ ਬਾਨ ਸ਼ਾਨ ਹੈ ਅੱਜ ਕੱਲ੍ਹ ਸ ਪੰਜਾਬੀ ਸੱਭਿਆਚਾਰਕ ਅਤੇ ਕਲਾ ਲਈ ਕਈ ਪ੍ਰੋਗਰਾਮ ਚਲਾਏ ਗਏ ਹਨ ਜਿਹਨਾਂ ਵਿੱਚ ਅੱਜ ਦੇ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਅਤੇ ਕਲਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਉਹਨਾਂ ਨੂੰ ਪਰ ਪ੍ਰੋਤਸਾਹਿਤ ਕੀਤਾ ਜਾਂਦਾ ਹੈ ਕਿ ਉਹ ਪੰਜਾਬੀ ਸੱਭਿਆਚਾਰ ਅਤੇ ਕਲਾ ਨਾਲ ਰੂਬਰੂ ਹੋਣ ਇਸ ਕਰਕੇ ਕਈ ਪ੍ਰੋਗਰਾਮ ਚਲਾਏ ਜਾਂਦੇ ਆ ਜਿਸ ਵਿੱਚ ਬੱਚੇ ਭਾਗੀਦਾਰ ਬਣਦੇ ਹਨ ਅਤੇ ਬੱਚੇ ਵੱਖ ਵੱਖ ਪੰਜਾਬੀ ਕਲਾਵਾਂ ਨੂੰ ਜਾਣ ਕੇ ਉਹਨਾਂ ਦਾ ਅਭਿਆਸ ਕਰਕੇ ਉਹ ਪ੍ਰੋਗਰਾਮ ਵਿੱਚ ਪੇਸ਼ ਕਰਦੇ ਹਨ ਜਿਸ ਨਾਲ ਪੰਜਾਬੀ ਸੱਭਿਆਚਾਰ ਅਤੇ ਕਲਾ ਵਿੱਚ ਹੋਰ ਵੀ ਜ਼ਿਆਦਾ ਵਿਕਾਸ ਹੋ ਜਾਂਦਾ ਹੈ ਅਤੇ ਬੱਚੇ ਪੰਜਾਬੀ ਸੱਭਿਆਚਾਰ ਬਾਰੇ ਜਾਣਨ ਲੱਗਦੇ ਹਨ